ਜੇਕਰ ਅਸੀਂ ਦੇਖੀਏ ਰੀਤੀ ਰਿਵਾਜ ਰਸਮਾਂ ਅੱਜ ਕੱਲ੍ਹ ਦੀ ਜੋ ਨੌਜਵਾਨ ਪੀੜੀ ਹੈ ਇਹਨਾਂ ਗੱਲਾਂ ਨੂੰ ਬਹੁਤ ਪਿੱਛੇ ਛੱਡਦੀ ਜਾ ਰਹੀ ਆ ਉਹ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਜਿਵੇਂ ਜਿਵੇਂ ਉਹ ਪੜ੍ਹ ਲਿਖ ਕੇ ਹਨ ਪਿੰਡਾਂ ਸ਼ਹਿਰਾਂ ਤੋਂ ਬਾਹਰ ਚਲੇ ਗਏ ਹਨ ਉਹ ਆਪਣੀਆਂ ਪੁਰਾਣੀਆਂ ਰੀਤੀ ਰਿਵਾਜ ਰਸਮਾਂ ਨੂੰ ਛੱਡ ਰਹੇ ਹਨ ਉਹਨਾਂ ਨੂੰ ਇੰਝ ਫੀਲ ਹੋ ਰਿਹਾ ਮਹਿਸੂਸ ਹੋ ਰਿਹਾ ਕਿ ਨੋਰਮਲ ਹੈ ਇਹਨਾਂ ਦਾ ਕੋਈ ਉਦੇਸ਼ ਨਹੀਂ ਹੈ ਉਹ ਅੱਗੇ ਤੋਂ ਅੱਗੇ ਜਾਂਦੇ ਆਪਣੀਆਂ ਇਹ ਸੱਭਿਆਚਾਰਕ ਕਦਰਾਂ ਕੀਮਤਾਂ ਭੁੱਲਦੇ ਜਾ ਰਹੇ ਹਨ ਵੈਸੇ ਇਹਨਾਂ ਦੀ ਪਕੜ ਕਰਨੀ ਚਾਹੀਦੀ ਹਨ ਤਾਂ ਕਿ ਆਉਣ ਵਾਲੀ ਪੀੜੀਆਂ ਨੂੰ ਵੀ ਸਾਡੇ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ ਹੈ